ਅੱਜ ਕੱਲ੍ਹ ਸਮੇਂ ਦੇ ਵਿੱਚ ਜ਼ਿਆਦਾਤਰ ਜਵਾਕਾਂ ਨੂੰ ਵੈਲਫੂਨ ਮੋਬਾਈਲ ਫੋਨ 'ਤੇ ਗੇਮਾਂ ਖੇਲਣ ਦਾ ਮਜ਼ਾ ਆਉਂਦਾ ਹੈ ਕਿਉਂਕਿ ਉਹਨਾਂ ਨੂੰ ਘਰ ਤੋਂ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ ਪਰ ਪੁਰਾਣੇ ਸਮਿਆਂ ਦੇ ਵਿੱਚ ਲੋਕ ਗੇਮ ਜ਼ਿਆਦਾਤਰ ਆਪਣੇ ਘਰ ਖੇਲਦੇ ਘਰ ਤੋਂ ਬਾਹਰ ਜਾ ਕੇ ਖੇਲਦੇ ਸੀਗੇ ਕਿਉਂਕਿ ਉਹਨਾਂ ਦੇ ਸ ਸਰੀਰ ਲਈ ਇਹ ਬਹੁਤ ਫਾਇਦੇਮੰਦ ਸੀਗਾ ਅਤੇ ਦੇ ਉਹਦੇ ਕਾਰਨ ਉਹ ਆਪਣਾ ਸਰੀਰ ਮਜਬੂਤ ਵੀ ਕਰ ਲੈਂਦੇ ਸੀਗੇ ਪਰ ਅੱਜ ਕੱਲ੍ਹ ਜ਼ਿਆਦਾਤਰ ਜਵਾਕ ਮੋਬਾਈਲ ਫੋਨ 'ਤੇ ਗੇਮ ਖੇਲਦੇ ਆ ਅਤੇ ਉਹ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਜਵਾਕਾਂ ਲਈ ਏ ਪਰ ਸਾਰਿਆਂ ਤੋਂ ਵੱਡਾ ਨੁਕਸਾਨ ਇਹ ਹੈ ਕਿ ਆਹ ਕਿ ਨੁਕਸਾਨ ਕਿ ਉਹਨਾਂ ਦਾ ਕਿਹੜੀਆਂ ਅੱਖਾਂ ਖਰਾਬ ਹੋ ਜਾਂਦੀਆਂ ਅਤੇ ਇਹਨਾਂ ਦੀ ਆਈਸੈਡ ਜਿਹੜੀ ਹੁੰਦੀ ਆ ਉਹ ਵੀਕ ਹੋ ਜਾਂਦੀ ਆ ਅਤੇ ਦੂਜਾ ਨੁਕਸਾਨ ਐਵੇਂ ਹੈ ਕਿ ਉਹ ਜ਼ਿਆਦਾਤਰ ਮੋਬਾਇਲ ਫੋਨ ਚਲਾਉਣ ਨਾਲ ਉਹਨਾਂ ਦਾ ਸਿਰ ਡਿਪਰੈਸ਼ਨ ਦਾ ਵਿਕਟਮ ਵੀ ਹੋ ਸਕਦੇ ਆ ਪਰ ਅੱਜ ਕੱਲ੍ਹ ਬੜੇ ਟੈਕਨੋਲੋਜੀ ਦੇ ਨਾਲ ਹੀ ਅਤੇ ਸਕੂਲ ਦੇ ਵਿੱਚ ਛੋਟੇ ਮੋਟੇ ਲੈਕਚਰਾਂ ਨਾਲ ਲੋਕ ਆਪਣੇ ਬੱਚਿਆਂ ਨੂੰ ਜਾਂ ਸਕੂਲ ਦੇ ਜਵਾਕਾਂ ਨੂੰ ਮੋਟੀਵੇਟ ਕਰ ਸਕਦੇ ਆ ਕਿ ਉਹਨਾਂ ਨੇ ਬਾਹਰ ਜਾ ਕੇ ਖੇਲਣਾ ਕਿਉਂਕਿ ਬਾਹਰ ਜਾ ਖੇਲਣ ਨਾਲ ਬਹੁਤ ਜ਼ਿਆਦਾ ਫਾਇਦੇ ਮਿਲਦੇ ਆ ਪਹਿਲਾ ਫਾਇਦਾ ਇਹ ਹੈ ਕਿ ਉਹਨਾਂ ਦਾ ਸਰੀਰ ਜਿਹੜਾ ਹੁੰਦਾ ਮਜ਼ਬੂਤ ਬਣ ਜਾਂਦਾ ਜਿਹੜੀ ਉਹਨਾਂ ਦੀ ਬੋਡੀ ਸ਼ੇਪ ਹੁੰਦੀ ਹੈ ਹੁੰਦੀ ਪ੍ਰੋਪਰ ਗੇਨ ਹੁੰਦੇ ਆ ਅਤੇ ਉਹਨਾਂ ਦੀ ਹਾਈਟ ਵਧੇਗੀ ਹਾਈਟ ਵੱਧਣ ਦੇ ਕਾਰਨ ਉਹ ਕੋਈ ਵੀ ਚੀਜ਼ ਚਾਹੇ ਉਹ ਚੱਕ ਸਕਦੇ ਆ ਅਤੇ ਜੇ ਉਹ ਬਾਹਰ ਰੋਜ਼ ਖੇਲੂਗੇ ਅਤੇ ਉਹਨਾਂ ਦਾ ਸਟੈਮੀਨਾ ਇਨਕਰੀਜ ਹੋਵੇਗਾ ਸਟੈਮੀਨਾ ਇਨਕਰੀਜ ਹੋਣ ਦੇ ਕਾਰਨ ਕਈ ਲੋਕਾਂ ਦਾ ਇੰਟਰਸਟ ਹੁੰਦਾ ਆਰਮੀ ਜੋਬ ਕਰਨ ਦਾ ਪੁਲਿਸ ਜੋਬ ਕਰਨ ਦਾ ਦੌੜ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਆ ਜੋ ਬਾਹਰ ਦੀ ਗੇਮਾਂ ਖੇਲੂਗੇ ਅਤੇ ਉਹ ਆਰਾਮ ਨਾਲ ਆਪਣੇ ਫਿਊਚਰ ਜੋਬ ਲੈ ਸਕਦੇ ਆ ਅਤੇ ਜ਼ਿਆਦਾਤਰ ਫਾਇਦੇਮੰਦ ਆਹੀ ਹੁੰਦੇ ਹੈ ਔਰ ਮੈਂ ਜ਼ਿਆਦਾਤਰ ਬਾਹਰ ਦੀ ਗੇਮਾਂ ਨਹੀਂ ਪਸੰਦ ਕਰਦਾ ਕਿਉਂਕਿ ਬਾਹਰ ਦੀ ਗੇਮਾਂ ਨਾ ਖੇਲਣ ਨਾਲ ਆਪਣੀ ਸਕਿੱਲ ਡਿਵੈਲਪ ਹੁੰਦੀ ਆ ਅਤੇ ਆਪਣੀ ਦੇ ਵਿੱਚ ਲੀਡਰਸ਼ਿਪ ਕੁਆਲਿਟੀ ਆਉਂਦੀ ਆ ਲੀਡਰਸ਼ਿਪ ਕੁਆਲਟੀ ਆਉਣ ਦੇ ਕਾਰਨ ਆਪਾਂ ਕੋਈ ਵੀ ਕਿਹੜਾ ਟਾਸਕ ਔਖਾ ਹੁੰਦਾ ਉਹਨੂੰ ਆਰਾਮ ਨਾਲ ਹੈਂਡਲ ਕਰ ਸਕਦੇ ਹਾਂ ਕਿ ਇਹਦੇ ਵਿੱਚ ਆਪਾਂ ਨੂੰ ਬਹੁਤ ਅਲੱਗ ਅਲੱਗ ਚੀਜ਼ਾਂ ਸਿੱਖਣ ਨੂੰ ਮਿਲੂਗੀਆਂ ਜੇ ਆਪਾਂ ਬਾਹਰ ਦੀ ਦੁਨੀਆਂ ਦੇ ਵਿੱਚ ਰਵਾਂਗੇ ਅਤੇ ਆਪਾਂ ਨੂੰ ਬਹੁਤ ਕੁਛ ਕਨੈਕਟ ਚੀਜ਼ਾਂ ਬਾਰੇ ਪੜ੍ਹਨ ਨੂੰ ਮਿਲੇਗਾ ਅਤੇ ਆਪਾਂ ਆਪਣੀ ਹਿਸਟਰੀ ਹਿਸਟਰੀ ਬਾਰੇ ਨਾਲ ਵੀ ਜੁੜੇ ਰਵਾਂਗੇ ਅਤੇ ਪਰ ਘਰ ਦੀ ਗੇਮਾਂ ਦੇ ਨਾਲ ਬੰਦਾ ਅੰਦਰ ਜੋਗਾ ਹੀ ਰਹਿ ਜਾਂਦਾ ਅਤੇ ਉਹ ਇੰਟਰਵਰਡ ਪਰਸਨੈਲਿਟੀ ਬਣ ਜਾਂਦਾ ਅਤੇ ਉਹ ਇੰਟਰੋਵਰਟ ਪਰਸਨੈਲਿਟੀ ਬਣਨ ਦੇ ਕਾਰਨ ਉਹ ਜ਼ਿਆਦਾਤਰ ਲੋਕਾਂ ਨਾਲ ਬੋਲਦਾ ਨਹੀਂ ਗਾ ਅਤੇ ਉਹ ਉਹਨਾਂ ਨੂੰ ਇਕੱਲੇ 'ਚ ਰਹਿਣਾ ਪਸੰਦ ਆ ਜਾਂਦਾ ਪਰ ਜੇ ਬਾਹਰ ਖੁਲੂਗਾ ਐਕਸਟਰੋਵਰਟ ਹੋਜੂਗਾ ਅਤੇ ਉਹ ਆਪਣੀ ਸਾਰੀ ਦਿਲ ਦੀ ਗੱਲ ਸਾਰਿਆਂ ਨਾਲ ਕਰੇਗਾ ਅਤੇ ਆਪਣਾ ਗੇਮ ਵੀ ਖੇਲੂਗਾ